ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਪੰਜਾਬੀ ਪਹਿਰਾਵੇ ਦੇ ਵਿੱਚ ਕੁੜਤਾ ਚਾਦਰਾ ਅਤੇ ਤੁਰਲੇ ਵਾਲੀ ਪੱਗ ਬੰਨ੍ਹੀ ਜਾਂਦੀ ਹੈ ਅਤੇ ਇਹ ਪਹਿਰਾਵਾ ਭੰਗੜਾ ਪਾਉਣ ਵਾਲੇ ਜਿਹੜੇ ਪੇਸ਼ਕਾਰ ਹੁੰਦੇ ਹਨ ਉਹਨਾਂ ਲਈ ਉਹਨਾਂ ਨੂੰ ਆਕਰਸ਼ਿਤ ਤਾਂ ਬਣਾਉਂਦਾ ਹੀ ਹੈ ਨਾਲ ਖੁੱਲ੍ਹਾ ਡੁੱਲ੍ਹਾ ਵੀ ਹੁੰਦਾ ਹੈ ਆਕਰਸ਼ਿਤ ਕਿਵੇਂ ਬਣਾਉਂਦਾ ਹੈ ਉਹ ਇਹ ਹੈ ਕਿ ਜਿਵੇਂ ਕਿ ਪੱਗ ਦੀ ਗੱਲ ਕਰੀਏ ਤਾਂ ਤੁਰਲੇ ਵਾਲੀ ਪੱਗ ਹੈ ਜਿਹੜੀ ਉਹ ਇਸ ਤਰ੍ਹਾਂ ਲੱਗਦੀ ਹੈ ਕਿ ਜਿਵੇਂ ਇੱਕ ਤਾਜ਼ ਜਿਹੜਾ ਪਹਿਨਿਆ ਹੋਵੇ ਜਿਵੇਂ ਕੋਈ ਕੁੱਕੜ ਦੇ ਕਲਗੀ ਹੁੰਦੀ ਹੈ ਉਸ ਤਰ੍ਹਾਂ ਮਤਲਬ ਉਹਦੀ ਦੇਖਣ ਨੂੰ ਉੱਪਰੋਂ ਜਿਹੜੀ ਹੈ ਉਹ ਵਿਜ਼ੀਵਲ ਬਣਾਉਂਦੀ ਹੈ ਅਤੇ ਖੁੱਲ੍ਹਾ ਕੁੜਤਾ ਜਿਹੜਾ ਉਹ ਸਰੀਰਿਕ ਤੁਹਾਡੀ ਜਿਹੜੀ ਫਿੱਟਨੈਸ ਹੈ ਉਹਦੇ ਤੌਰ 'ਤੇ ਵੀ ਉਹਨੂੰ ਆਕਰਸ਼ਿਤ ਕਰਦਾ ਹੈ ਅਤੇ ਚਾਦਰਾ ਜਿਹੜਾ ਲਹਿਰੀਆ ਚਾਦਰਾ ਅਤੇ ਥੱਲੇ ਨੋਕਦਾਰ ਜੁੱਤੀ ਹੈ ਜਿਹੜੀ ਉਹ ਮਤਲਬ ਤੁਰਨ ਦੇ ਵਿੱਚ ਭੰਗੜਾ ਪਾਉਣ ਦੇ ਵਿੱਚ ਸਹਾਈ ਵੀ ਹੁੰਦੀ ਹੈ ਅਤੇ ਜ਼ਿਆਦਾ ਆਕਰਸ਼ਿਤ ਵੀ ਬਣਾਉਂਦੀ ਹੈ